ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਿਹੜਾ ਪੰਜਾਬੀ ਧਰਮ ਆ ਇਹਦੇ ਵਿੱਚ ਕੁੜੀਆਂ ਨੂੰ ਸੂਟ ਸਲਵਾਰ ਅਤੇ ਮੁੰਡੇ ਕੁੜਤਾ ਪਜਾਮਾ ਪਾ ਕੇ ਰੱਖਦੇ ਆ ਅਤੇ ਇਹਦੇ ਵਿੱਚ ਕੀ ਹੈ ਕਿ ਜਿਹੜੇ ਅੰਮ੍ਰਿਤਧਾਰੀ ਲੋਕ ਹੁੰਦੇ ਆ ਅੰਮ੍ਰਿਤਧਾਰੀ ਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਆ ਉਹਨਾਂ ਦੇ ਪੰਜ ਕਕਾਰ ਹੈਗੇ ਆ ਕੇਸ ਇਹ ਕਿਰਪਾਨ ਕੰਘਾ ਅਤੇ ਕੜਾ ਇਸ ਜਿਹੜੇ ਚੀਜ਼ਾਂ ਆ ਧਿਆਨ ਰੱਖਣਾ ਚਾਹੀਦਾ ਪਹਿਲਾਂ ਤਾਂ ਜਿਹੜਾ ਅੰਮ੍ਰਿਤਧਾਰੀ ਸਿੱਖ ਆ ਉਹਨੇ ਕੇਸ ਨਹੀਂ ਕਟਾਣੇ ਜਦੋਂ ਅੰਮ੍ਰਿਤ ਉਹਨੇ ਛੱਕ ਲਿਆ ਆ ਉਹਨੇ ਕੇਸ ਨਹੀਂ ਕਟਵਾਉਣੇ ਕੇਸ ਜਿਹੜੇ ਆ ਉਹ ਗੁਰੂ ਦੀ ਦਾਤ ਮੰਨੇ ਗਏ ਆ ਇਸ ਕਰਕੇ ਪ ਜਿਹੜਾ ਪੰਜਾਬੀ ਸਿੱਖ ਧਰਮ 'ਚ ਆ ਗਿਆ ਆ ਜਿਹਨੇ ਇਹਨੂੰ ਅਪਣਾ ਲਿਆ ਵਾ ਉਹ ਕੇਸ ਦੀ ਕੁਰਬਾਨੀ ਨਹੀਂ ਦੇ ਸਕਦਾ ਉਸ ਤੋਂ ਬਾਅਦ ਫਿਰ ਕੀ ਹੈ ਜੀ ਜਦੋਂ ਅਸੀਂ ਗੁਰਦੁਆਰੇ ਦੇ ਅੰਦਰ ਜਾਂਦੇ ਹਾਂ ਫਿਰ ਸਾਨੂੰ ਸਿਰ ਢੱਕਣਾ ਚਾਹੀਦਾ ਆ ਜਿਹੜਾ ਅੰਮ੍ਰਿਤਧਾਰੀ ਸਿੱਖ ਆ ਸਿੰਘਣੀ ਆ ਉਹਦਾ ਸਿਰ ਕਦੇ ਵੀ ਨੰਗਾ ਨਹੀਂ ਹੋਣਾ ਚਾਹੀਦਾ ਉਹਦਾ ਸਿਰ ਹਮੇਸ਼ਾਂ ਢਕਿਆ ਹੋਣਾ ਚਾਹੀਦਾ ਆ ਜੀ ਫਿਰ ਉਸ ਤੋਂ ਬਾਅਦ ਕੀ ਆ ਕਿ ਇਹਨਾਂ ਨੇ ਆਪਣੀ ਕਿਰਪਾਨ ਨਾ ਤਾਂ ਧਿਆਨ ਰੱਖਣਾ ਏ ਆ ਜਿਹੜੇ ਪੰਜ ਕਕਾਰ ਆ ਜਿਹਨਾਂ ਵਿੱਚੋਂ ਇੱਕ ਕਕਾਰ ਹੈਗਾ ਵਾ ਕੰਘਾ ਜਿਹੜਾ ਕੰਘਾ ਵਾ ਉਹ ਸ਼ਾਮ ਨੂੰ ਦੋ ਟਾਈਮ ਇੱਕ ਟਾਈਮ ਸਵੇਰੇ ਅਤੇ ਇੱਕ ਟਾਈਮ ਸ਼ਾਮ ਨੂੰ ਕਰਨਾ ਆ ਜਿਹੜਾ ਕੰਘਾ ਆ ਉਹ ਕੇਸ ਨੂੰ ਤਰੋ ਤਾਜ਼ਾ ਰੱਖਦੇ ਆ ਤਾਂ ਕਰਕੇ ਕੰਘੇ ਦਾ ਉਪਯੋਗ ਸਾਨੂੰ ਜਿਹੜਾ ਆ ਗੁਰੂ ਜੀ ਨੇ ਦਿੱਤਾ ਹੋਇਆ ਵਾ ਅਤੇ ਜਿਹੜੀ ਕਿਰਪਾਨ ਆ ਇਹ ਪਹਿਲਾਂ ਦੇ ਟਾਈਮ 'ਚ ਜਦੋਂ ਜਾਨਵਰਾਂ ਦੇ ਕਾਫੀ ਹਮਲੇ ਹੁੰਦੇ ਸੀਗੇ ਅਤੇ ਆਪਣੇ ਉਸ ਵਾਸਤੇ ਦਿੱਤੇ ਹੋਏ ਆ ਕਿ ਆਪਾਂ ਆਪਣੇ ਆਪ ਨੂੰ ਕਿਸੇ ਵੀ ਮੁਸੀਬਤ ਤੋਂ ਬਚਾ ਸਕੀਏ ਅਤੇ ਜਿਹੜੀ ਹੈਗੀ ਜਿਹੜਾ ਸਾਡਾ ਕੜਾ ਆ ਇਹ ਸਾਨੂੰ ਕਿਸੇ ਗਲਤ ਰਾਹੀਂ ਨਹੀਂ ਪੈਣ ਦਿੰਦਾ ਇਹ ਸਿੱਖ ਨੂੰ ਹਮੇਸ਼ਾਂ ਇੱਕ ਸਿੱਧੇ ਰਾਹ ਪਾਉਂਦਾ ਵਾ ਇਹ ਸਾਨੂੰ ਦੱਸਦਾ ਵਾ ਕਿ ਅਸੀਂ ਕੋਈ ਵੀ ਕੰਮ ਆ ਉਹ ਆਪਣੀ ਕਿੱਦਾਂ ਆਪਣੀ ਮਰਿਆਦਾ 'ਚ ਰਹਿ ਕੇ ਕਰਨਾ ਵਾ ਇਹ ਸਾਨੂੰ ਬਾਹਰ ਨਹੀਂ ਜਾਣ ਦਿੰਦਾ ਸਾਡੀ ਮਰਿਆਦਾ ਤੋਂ ਅਤੇ ਇੱਦਾਂ ਹੀ ਆਪਾਂ ਜਿਹੜੇ ਹੈ ਸਿੱਖ ਧਰਮ ਬਹੁਤ ਵਧੀਆ ਧਰਮ ਆ ਇਹਨਾਂ ਚੀਜ਼ਾਂ ਨੂੰ ਅਗਰ ਫੋਲੋ ਕਰੀਏ ਨਾ ਅਤੇ ਮਤਲਬ ਪ੍ਰਭੂ ਨੂੰ ਮਿਲਿਆ ਜਾ ਸਕਦਾ ਆ ਪ੍ਰਭੂ ਬਾਰੇ ਸਮਝਿਆ ਜਾ ਸਕਦਾ ਆ ਅਤੇ ਇਹਨਾਂ ਵਿੱਚ ਸਾਡਾ ਕੋਈ ਬੁਰਾ ਤਾਂ ਨਹੀਂ ਹੈਗਾ ਪਰ ਚਲੋ ਬਹੁਤ ਵਧੀਆ ਜਿਹੜਾ ਆ ਇਸ ਬਾਰੇ ਦੱਸਦੇ ਆ ਗੁਰੂ ਜੀ ਨੇ ਬੜਾ ਵਧੀਆ ਦਾਤ ਦਿੱਤੀ ਹੋਈ ਸਾਨੂੰ ਬਾਣੀਆਂ ਦੀ ਪੰਜਾਂ ਕਕਾਰਾਂ ਦੀ ਅਤੇ ਗੁਰੂ ਜੀ ਦੇ ਬਹੁਤ ਬਹੁਤ ਆਪਾਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇੰਨਾਂ ਵਧੀਆ ਧਰਮ ਇੰਨਾਂ ਵਧੀਆ ਪੰਥ ਸਾਜਣਾ ਕਰਕੇ ਦਿੱਤੀ ਆ ਅਤੇ ਜਿਹੜਾ ਪ੍ਰਭੂ ਦੀ ਲਗਨ 'ਚ ਲੱਗਿਆ ਆ ਬਸ ਉਹ ਸਾਧਕ ਜਿਹੜਾ ਪ੍ਰਭੂ ਦੇ ਨਾਲ ਜੁੜਿਆ ਆ ਨਾ ਉਹੀ ਪ੍ਰਭੂ ਦੀ ਮਹਿਮਾ ਨੂੰ ਸਮਝ ਸਕਦਾ ਏ ਆ ਧੰਨਵਾਦ